ਪੰਜਾਬੀ ਹਜ਼ਾਰਾਂ ਵਿੱਚੋਂ ਅਲੱਗ ਦਿਖਦੇ ਹਨ ਕਿਉਂਕਿ ਉਹਨਾਂ ਦੇ ਪਹਿਰਾਵੇ ਕਰਕੇ ਉਹਨਾਂ ਦਾ ਪਹਿਰਾਵਾ ਸਾਰਿਆਂ ਨਾਲੋਂ ਅਲੱਗ ਹੁੰਦਾ ਹੈ ਜਿਵੇਂ ਕਿ ਮਰਦਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਸਿਰ 'ਤੇ ਪੱਗ ਜਿਹੜੀ ਕਿ ਉਹਨਾਂ ਦੀ ਸ਼ੋਭਾ ਵੀ ਵਧਾਉਂਦੀ ਹੈ ਅਤੇ ਉਹ ਸਾਰਿਆਂ ਨਾਲੋਂ ਅਲੱਗ ਦਿਖਦੇ ਨੇ ਜੇਕਰ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਸਿਰ 'ਤੇ ਚੁੰਨੀ ਅਤੇ ਸੂਟ ਸਲਵਾਰ ਉਹਨਾਂ ਦੀ ਸ਼ੋਭਾ ਵਧਾਉਂਦੀ ਹੈ ਅਤੇ ਪੰਜਾਬੀਆਂ ਦੇ ਰੀਤੀ ਰਿਵਾਜ਼ ਬਹੁਤ ਜ਼ਿਆਦਾ ਅਲੱਗ ਹੁੰਦੇ ਹਨ ਜਿਨ੍ਹਾਂ ਕਰਕੇ ਉਹਨਾਂ ਦੀ ਅਲੱਗ ਪਹਿਚਾਣ ਕੀਤੀ ਜਾਂਦੀ ਹੈ ਅਤੇ ਉਹਨਾਂ ਦੇ ਖਾਣਾ ਪੀਣਾ ਵੀ ਅਲੱਗ ਹੁੰਦਾ ਹੈ ਜਿਸ ਨਾਲ਼ ਉਹਨਾਂ ਦੀ ਬਹੁਤ ਜ਼ਿਆਦਾ ਜਿਹੜੇ ਕਿ ਦੁਨੀਆਂ ਭਰ 'ਚ ਉਹਨਾਂ ਦੀ ਵਾਹ ਵਾਹ ਹੁੰਦੀ ਹੈ ਅਤੇ ਉਹਨਾਂ ਦੀ ਪਹਿਚਾਣ ਹੁੰਦੀ ਹੈ